ਅਠਾਈ ਅਗਸਤ ਉੱਨੀ ਸੌ ਸਤਾਨਵੇਂ ਵੀਹ ਜਨਵਰੀ ਉੱਨੀ ਸੌ ਤਰਾਨਵੇਂ ਵੀਹ ਮਾਰਚ ਦੋ ਹਜ਼ਾਰ ਵੀਹ ਉੱਨੀ ਦਸਬੰਰ ਦੋ ਹਜ਼ਾਰ ਇੱਕੀ ਦੋ ਫਰਵਰੀ ਦੋ ਹਜ਼ਾਰ ਬਾਈ